ਹਾਂਜੀ ਪੈਟਰੋਲ ਦੀਆਂ ਕੀ ਵਧਦੀਆਂ ਕੀਮਤਾਂ ਨੇ ਮੇਰੀ ਬਾਈਕਿੰਗ ਨੂੰ ਜਰੂਰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ ਜਦੋਂ ਪੈਟਰੋਲ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ ਤਾਂ ਸਿਰਫ ਰਾਈਡਿੰਗ ਦਾ ਖਰਚਾ ਦੀ ਵੱਧ ਜਾਂਦਾ ਬਲਕਿ ਇਹ ਮੇਰੀ ਮਤਲਬ ਸਾਰੀ ਜਿੰਦਗੀ ਮੇਰੀ ਸਾਰੀ ਜ਼ਿੰਦਗੀ 'ਚ ਅਸਰ ਪੈਦਾ ਕਰਦਾ ਹੈ ਇਸ ਦੇ ਨਾਲ ਜਦੋਂ ਬਾਈਕ 'ਤੇ ਜਾਂ ਜਿਆਦਾ ਉਪਯੋਗ ਵਧ ਜਾਂਦਾ ਹੈ ਤਾਂ ਕਾਰਬਨ ਭੀਸ਼ਨ ਵੱਧ ਜਾਂਦੇ ਨੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ਜੋ ਕਿ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਬਾਲਣ ਦੀ ਜਿਆਦਾ ਵਰਤੋਂ ਨਾਲ ਨਾ ਸਿਰਫ ਪੈਟਰੋਲ ਦੀਆਂ ਕੀਮਤਾਂ ਤੇ ਖਰਚਾ ਵਧਦਾ ਹੈ ਬਲਕਿ ਇਨਵਾਇਰਮੈਂਟ ਜਾਨੀ ਵਾਤਾਵਰਣ ਵੀ ਬੁਰੇ ਵਾਤਾਵਰਨ ਤੇ ਵੀ ਬਹੁਤ ਜਿਆਦਾ ਬੁਰਾ ਅਸਰ ਪੈਂਦਾ ਹੈ ਜਿਵੇਂ ਗਰੀਨ ਹਾਊਸ ਗੈਸ ਜੋ ਕਿ ਵਾਤਾਵਰਨ ਨੂੰ ਹੋਰ ਵੀ ਬੜਾ ਵਾ ਦਿੰਦਾ ਹੈ ਇਸ ਲਈ ਇਨਾ ਦਾ ਵੀ ਘੱਟ ਉਪਯੋਗ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਾ ਪਵੇ ਤੇ ਆਪਣੀ ਜਿੰਦਗੀ ਵਿੱਚ ਵੀ ਇਹਨਾਂ ਦਾ ਅਸਰ ਨਾ ਹੋ